ਭਾਰਤ ਵਿੱਚ ਭੋਜਨ ਬਹੁਤ ਤਰ੍ਹਾਂ ਦੇ ਹਨ ਅਤੇ ਰੋਜ਼ਾਨਾ ਜੀਵਨ ਵਿੱਚ ਬਣਾਏ ਜਾਣ ਵਾਲੇ ਜਿਵੇਂ ਕਿ ਪੰਜਾਬੀ ਭੋਜਨ ਪੰਜਾਬੀ ਭੋਜਨ ਬਹੁਤ ਵਧੀਆ ਹੈ ਜਿਵੇਂ ਕਿ ਸਰਸੋਂ ਦਾ ਸਾਗ ਮੱਕੀ ਦੀ ਰੋਟੀ ਲੱਸੀ ਅਤੇ ਪਰਾਂਠੇ ਮੱਕੀ ਦੀ ਰੋਟੀ ਅਤੇ ਸਾਗ ਪੰਜਾਬੀ ਭੋਜਨ ਦਾ ਬਹੁਤ ਫ਼ੇਮਸ ਭੋਜਨ ਹੈ ਹੋਰ ਹਿਮਾਚਲੀ ਭੋਜਨ ਦੇ ਵਿੱਚ ਦਾਲ ਚਾਵਲ ਬਹੁਤ ਫ਼ੇਮਸ ਹੈ ਇੱਥੇ ਦੇ ਲੋਕ ਬਹੁਤ ਪਸੰਦ ਕਰਦੇ ਹਨ ਹਿਮਾਚਲੀ ਭੋਜਨ ਬੰਗਾਲੀ ਭੋਜਨ ਦੇ ਵਿੱਚ ਮਛਲੀ ਚਾਵਲ ਇਹ ਸਾਰੀ ਚੀਜ਼ਾਂ ਬਣਦੀਆਂ ਹਨ ਉਸ ਤੋਂ ਬਾਅਦ ਸਾਉਥ ਇੰਡੀਆ ਦਾ ਵੀ ਭੋਜਨ ਭਾਰਤ ਵਿੱਚ ਬਣਾਇਆ ਜਾਂਦਾ ਹੈ ਜਿਵੇਂ ਇਹਦੇ ਵਿੱਚ ਇਡਲੀ ਹੋ ਗਿਆ ਡੋਸਾ ਹੋ ਗਿਆ ਇਹ ਵਗੈਰਾ ਸਾਉਥ ਇੰਡੀਆ ਦੇ ਵਿੱਚ ਬਣਾਏ ਜਾਂਦੇ ਹਨ ਭਾਰਤ ਵਿੱਚ ਵੱਖ ਵੱਖ ਤਰੀਕਿਆਂ ਦਾ ਭੋਜਨ ਇਸ ਲਈ ਬਣਾਇਆ ਜਾਂਦਾ ਹੈ ਕਿਉਂਕਿ ਇੱਥੇ ਵੱਖ ਵੱਖ ਤਰ੍ਹਾਂ ਦੇ ਲੋਕ ਰਹਿੰਦੇ ਹਨ ਵੱਖ ਵੱਖ ਜਗ੍ਹਾ ਦੇ ਲੋਕ ਰਹਿੰਦੇ ਹਨ ਇੱਥੇ ਦਾ ਭੋਜਨ ਇਸ ਕਰਕੇ ਬਹੁਤ ਵਧੀਆ ਹੈ ਅਤੇ ਅੱਜ ਕੱਲ੍ਹ ਨੋਰਮਲ ਭੋਜਨ ਦੇ ਜਿਵੇਂ ਬਜ਼ਰਗ ਬਜ਼ੁਰਗ ਹੋ ਗਏ ਅਤੇ ਆਮ ਲੋਕ ਹੋ ਗਏ ਦਾਲ ਰੋਟੀ ਚਾਵਲ ਸਬਜ਼ੀ ਇਹ ਫ਼ੇਮਸ ਹੈ ਸਾਰਿਆਂ ਲਈ ਪਰ ਅੱਜ ਕੱਲ੍ਹ ਦੇ ਬੱਚੇ ਬਰਗਰ ਹੋ ਗਿਆ ਪੀਜ਼ਾ ਹੋ ਗਿਆ ਨਿਊਡਲ ਇਹ ਸਾਰੀ ਚੀਜ਼ ਖਾਂਦੇ ਹਨ ਹੋਰ ਇੱਥੇ ਦੀ ਭਾਰਤ ਦੀ ਫ਼ੇਮਸ ਚੀਜ਼ ਹੈ ਰੁਮਾਲੀ ਰੋਟੀ ਸਬਜ਼ੀ ਵਗੈਰਾ ਅਤੇ ਇਹ ਭਾਰਤ ਦੀ ਫ਼ੇਮਸ ਚੀਜ਼ ਹੈ ਅਤੇ ਇੱਥੇ ਲੋਕ ਬਹੁਤ ਸਾਰੀ ਚੀਜ਼ਾਂ ਪਸੰਦ ਕਰਦੇ ਹਨ ਭਾਰਤ ਦਾ ਪ੍ਰਸਿੱਧ ਭੋਜਨ ਹੈ